ਜੇਕਰ ਦੇਖਿਆ ਜਾਵੇ ਤਾਂ ਅੱਜ ਦੇ ਸਮੇਂ ਵਿੱਚ ਸਾਡੇ ਦੇਸ਼ ਦੇ ਸਾਰੇ ਹਸਪਤਾਲ ਵੈਸੇ ਤਾਂ ਪਹਿਲਾਂ ਨਾਲੋਂ ਬਹੁਤ ਚੰਗੇ ਹੋ ਚੁੱਕੇ ਹਨ ਅਤੇ ਉਹਨਾਂ ਦੇ ਵਿੱਚ ਬਹੁਤ ਸੁਧਾਰ ਕੀਤਾ ਜਾ ਕੀਤਾ ਜਾ ਚੁੱਕਾ ਹੈ ਮਗਰ ਮੇਰੇ ਕੋਲ ਜਿਹੜਾ ਸਿਵਲ ਹਸਪਤਾਲ ਮੇਰੇ ਜ਼ਿਲ੍ਹੇ ਵਿੱਚ ਪੈਂਦਾ ਹੈ ਉਸ ਵਿੱਚ ਹਾਲੇ ਵੀ ਸੁਧਾਰ ਕਰਨ ਦੀ ਬਹੁਤ ਲੋੜ ਹੈ ਉੱਥੇ ਸਰਕਾਰਾਂ ਨੇ ਵੀ ਬਹੁਤ ਜ਼ੋਰ ਲਾਇਆ ਪਰ ਉਸ ਨੂੰ ਸਫਲ ਕਰਨ ਵਿੱਚ ਕਾਮਯਾਬ ਨਹੀਂ ਰਹੇ ਉੱਥੋਂ ਦਾ ਸਟਾਫ ਬਹੁਤ ਹੀ ਘੱਟ ਹੈ ਜਿਸ ਕਾਰਨ ਚੰਗੀ ਤਰ੍ਹਾਂ ਇਲਾਜ ਨਹੀਂ ਹੁੰਦਾ ਹੈ ਕਈ ਮਰੀਜ਼ ਬਿਨਾ ਇਲਾਜ ਦੇ ਹੀ ਰਹੇ ਰਹਿ ਜਾਂਦੇ ਹਨ ਅਤੇ ਉੱਥੋਂ ਦੀਆਂ ਲੈਬਾਂ ਵਿੱਚ ਵੀ ਪੂਰਾ ਚੰਗੀ ਤਰ੍ਹਾਂ ਸਾਰੇ ਉਪਕਰਣ ਉਪਲਬਧ ਨਹੀਂ ਹਨ ਅਤੇ ਬਹੁਤ ਸਾਰੇ ਮਰੀਜ਼ ਉੱਥੇ ਇਹੋ ਜਿਹੇ ਵੀ ਨੇ ਜਿਨ੍ਹਾਂ ਨੂੰ ਕਈ ਵਾਰੀ ਤਾਂ ਬੈੱਡ ਵੀ ਨਹੀਂ ਮਿਲਦਾ ਹੈ ਅਤੇ ਉਹਨਾਂ ਨੂੰ ਥੱਲੇ ਹੀ ਪੈਣਾ ਪੈਂਦਾ ਹੈ ਜਿਸ ਕਾਰਨ ਕਿ ਉਹਨਾਂ ਦਾ ਚੰਗੀ ਤਰ੍ਹਾਂ ਇਲਾਜ ਵੀ ਨਹੀਂ ਹੁੰਦਾ ਹੈ ਦੇਖਿਆ ਜਾਵੇ ਤਾਂ ਉੱਥੋਂ ਦਾ ਸਟਾਫ ਜੋ ਵੀ ਹੈ ਉਹ ਚੰਗੀ ਤਰ੍ਹਾਂ ਪੇਸ਼ੈਂਟ ਨਾਲ ਡੀਲ ਵੀ ਨਹੀਂ ਕਰਦਾ ਹੈ ਅਤੇ ਉਹ ਪੇਸ਼ੈਂਟ ਨੂੰ ਇਲਾਜ ਕਰਨ ਦੀ ਬਜਾਏ ਉਸਨੂੰ ਹੋਰ ਵੀ ਤਰਸਾਉਂਦਾ ਹੈ ਅਤੇ ਉਸਦਾ ਸਮਾਂ ਜਾਇਆ ਕਰਦਾ ਹੈ